ਹਾਂ ਮੈਂ ਸਾਰਕ ਟੈਂਕ ਸ਼ੋ ਬਾਰੇ ਜਾਣਦਾ ਹਾਂ ਇਹ ਕਾਰੋਬਾਰ ਸ਼ੁਰੂ ਕਰਨ ਲਈ ਲੋਕਾਂ ਨੂੰ ਯੋਗਦਾਨ ਦਿੰਦਾ ਹੈ ਨਵਾਂ ਕਾਰੋਬਾਰੀ ਆਪਣੇ ਕਾਰੋਬਾਰ ਨੂੰ ਦੱਸਦਾ ਹੈ ਅਤੇ ਉਸ ਤੇ ਕਿੰਨਾ ਖਰਚ ਆਉਂਦਾ ਹੈ ਅਤੇ ਸ਼ਾਰਕ ਟੈਂਕ ਦੇ ਸਾਰਕ ਇਸ ਵਿੱਚ ਆਪਣੀ ਹਿੱਸੇਦਾਰੀ ਅਨੁਸਾਰ ਉਹਨਾਂ ਨੂੰ ਪੈਸਾ ਦਿੰਦੇ ਹਨ ਅਤੇ ਆਪਣਾ ਹਿੱਸਾ ਰੱਖਦੇ ਹਨ ਜਿਸ ਨਾਲ ਨਵੇਂ ਕਾਰੋਬਾਰਾਂ ਦਾ ਕੰਮ ਚੱਲ ਸਕੇ ਤੇ ਉਹਨਾਂ ਨੂੰ ਲਾਭ ਹੋ ਸਕੇ